ਪੰਜਾਬੀ ਵਪਾਰ ਨੂੰ ਵਿਸ਼ਵ ਪੱਧਰ 'ਤੇ ਵਧਾਉਣ ਲਈ ਆਧੁਨਿਕ ਤਕਨੀਕ ਨਵੀਆਂ ਵਪਾਰ ਨੀਤੀਆਂ ਅਤੇ ਮਾਰਕੀਟਿੰਗ ਰਣਨੀਤੀਆਂ ਨੂੰ ਅਪਣਾਉਣਾ ਬਹੁਤ ਜ਼ਰੂਰੀ ਹੈ ਡਿਜਿਟਲ ਮਾਰਕੀਟਿੰਗ ਅਤੇ ਈ ਕਮਰਸ ਪਲੇਟਫਾਰਮ ਜਿਵੇਂ ਕਿ ਮਿਜ਼ਨ ਅਲੀਬਾਬਾ ਈਬੇ ਅਤੇ ਪੰਜਾਬੀ ਉਤਪਾਦਾਂ ਦੀ ਉਪਲੱਬਧਤਾ ਵਧਾਉਣੀ ਚਾਹੀਦੀ ਹੈ ਤਾਂ ਕਿ ਵਿਦੇਸ਼ੀ ਗ੍ਰਾਹਕ ਵੀ ਇਨ੍ਹਾਂ ਤੱਕ ਆਸਾਨੀ ਨਾਲ ਪਹੁੰਚ ਸਕਣ ਸੋਸ਼ਲ ਮੀਡੀਆ ਫੇਸਬੁੱਕ ਇੰਸਟਾਗ੍ਰਾਮ ਯੂਟਿਊਬ ਅਤੇ ਲਿੰਕਡੇਨ ਰਾਹੀਂ ਉਤਪਾਦਾਂ ਦੀ ਵਿਸ਼ਵ ਪੱਧਰੀ ਪਬਲੀਸਿਟੀ ਕਰਨੀ ਚਾਹੀਦੀ ਹੈ ਹੋ ਸਕਦੀ ਹੈ ਸਰਕਾਰ ਵਲੋਂ ਮਿਲ ਰਹੀਆਂ ਰਿਆਤ ਸਹੂਲਤਾਂ ਅਤੇ ਵਪਾਰ ਸਬਸਿਡੀਆਂ ਦਾ ਪੂਰਾ ਲਾਭ ਲੈਣਾ ਚਾਹੀਦਾ ਹੈ ਤਾਂ ਕੀ ਵਪਾਰੀ ਆਪਣੇ ਉਤਪਾਦਾਂ ਨੂੰ ਵਿਦੇਸ਼ੀ ਮਾਰਕੀਟਾਂ ਤੱਕ ਪਹੁੰਚਾ ਸਕਣ ਅੰਤਰਰਾਸ਼ਟਰੀ ਵਪਾਰ ਮੇਲੇ ਐਕਸਪੋਜ ਅਤੇ ਬਿਜਨਸ ਸਮਾਗਮਾਂ ਵਿੱਚ ਸ਼ਾਮਿਲ ਹੋਣਾ ਵੀ ਪੰਜਾਬੀ ਉਤਪਾਦਾਂ ਲਈ ਨਵੇਂ ਬਜਾਰ ਖੋਲ੍ਹ ਸਕਦਾ ਹੈ ਇਸ ਤੋਂ ਇਲਾਵਾ ਨਵੀਂ ਤਕਨੀਕ ਉੱਚ ਗੁਣਵੱਤਾ ਵਾਲੀ ਪੈਕਿੰਗ ਅਤੇ ਵਿਦੇਸ਼ੀ ਮੰਗ ਦੇ ਮੁਤਾਬਿਕ ਉਤਪਾਦਨ ਕਰਕੇ ਪੰਜਾਬੀ ਵਪਾਰ ਨੂੰ ਗਲੋਬਲ ਮਾਰਕੀਟ ਵਿੱਚ ਮਜ਼ਬੂਤ ਬਣਾਇਆ ਜਾ ਸਕਦਾ ਹੈ